ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਕੱਲ੍ਹ ਕਦੋਂ ਆਏ ਸੀ ਜੀ ਤੁਸੀਂ ਅੱਛਿਆ ਜੀ ਮੈਡਮ ਇੱਦਾਂ ਤਾਂ ਨਹੀਂ ਹੋ ਸਕਦਾ ਸਾਡਾ ਤਾਂ ਬਹੁਤ ਵਧੀਆ ਕੁਆਲਿਟੀ ਅਤੇ ਫਰੈੱਸ਼ ਆਲੂ ਵਧੀਆ ਕੁਆਲਿਟੀ ਦਾ ਆਟਾ ਅਸੀਂ ਵਰਤਦੇ ਹਾਂ ਤੁਸੀਂ ਕੁਛ ਹੋਰ ਰੀਜਨ ਦੇਖੋ ਇਸ ਕਰਕੇ ਤਾਂ ਤੁਹਾਡੀ ਬੇਟੀ ਦਾ ਪੇਟ ਖ਼ਰਾਬ ਨਹੀਂ ਹੋ ਸਕਦਾ ਗਿਆਰ੍ਹਾਂ ਵਜੇ ਤਾਂ ਅਸੀਂ ਤਾਜ਼ਾ ਤਾਜ਼ਾ ਹੀ ਬਣਾਇਆ ਸੀ ਨਹੀਂ ਜੀ ਨਹੀਂ ਸਮੈਲ ਤੁਹਾਨੂੰ ਵੈਸੇ ਹੀ ਲੱਗ ਰਿਹਾ ਹੋਏਗਾ ਸਮੈਲ ਦਾ ਤਾਂ ਕੋਈ ਸਕੋਪ ਹੀ ਨਹੀਂ ਹੈ ਅਸੀਂ ਰੋਜ਼ ਤਾਜ਼ਾ ਆਟਾ ਗੁੰਨਦੇ ਹਾਂ ਤਾਜ਼ੇ ਆਲੂ ਐਨ ਮੌਕੇ 'ਤੇ ਬੋਇਲ ਹੁੰਦੇ ਨੇ ਅਤੇ ਵਧੀਆ ਕਿਸਮ ਦੇ ਅਸੀਂ ਮਸਾਲੇ ਯੂਜ਼ ਕਰਦੇ ਹਾਂ ਇਹ ਤਾਂ ਮੈਂ ਨਹੀਂ ਮੰਨਦੀ ਕਿ ਇਸ ਕਾਰਨ ਕਰਕੇ ਪੇਟ ਖ਼ਰਾਬ ਹੋਇਆ ਹੋਵੇ ਨਹੀਂ ਜੀ ਅਸੀਂ ਤਾਂ ਅਮੂਲ ਦਾ ਬਟਰ ਯੂਜ਼ ਕਰਦੇ ਹਾਂ ਅਤੇ ਵਿਦਇਨ ਕੁਆਲਿਟੀ ਲਿਮਿਟਸ ਦੇ ਵਿੱਚ ਹੁੰਦਾ ਉਹਦੀ ਐਕਸਪਾਇਰੀ ਪ੍ਰੋਪਰ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਹਾਂ ਕਿ ਉਹਦੇ ਅਸੀਂ ਰੈਪਰਸ ਸਾਰੇ ਸੰਭਾਲ ਕੇ ਰੱਖਦੇ ਹਾਂ ਤੁਸੀਂ ਕਦੇ ਵੀ ਦੁਕਾਨ 'ਤੇ ਆ ਕੇ ਦੇਖ ਸਕਦੇ ਓਂ ਮੱਖਣ ਦੀ ਕੁਆਲਿਟੀ ਸਾਡੀ ਨਹੀਂ ਜੀ ਨਹੀਂ ਅਸੀਂ ਤੁਹਾਨੂੰ ਤੁਸੀਂ ਕਦੇ ਵੀ ਸਾਡੀ ਇੱਥੇ ਆ ਕੇ ਤੁਸੀਂ ਵਿਜਿਟ ਕਰੋ ਆਪਾਂ ਗੱਲਬਾਤ ਕਰਕੇ ਗੱਲ ਨੂੰ ਸੋਲਵ ਕਰਾਂਗੇ ਤੁਹਾਡੀ ਬੇਟੀ ਦੇ ਬਿਮਾਰ ਹੋਣ ਦਾ ਕੋਈ ਹੋਰ ਵੀ ਕਾਰਨ ਹੋ ਸਕਦਾ ਤੁਸੀਂ ਇੱਕ ਵਾਰੀ ਦੁਬਾਰਾ ਸਾਰਾ ਚੈੱਕ ਕਰੋ ਸਾਡੇ ਤਾਂ ਰੋਜ਼ ਸੌ ਕਸਟਮਰ ਆ ਕੇ ਖਾ ਕੇ ਜਾਂਦਾ ਸਿਰਫ਼ ਇੱਕ ਤੁਸੀਂ ਹੋਈ ਹੋ ਜਿਨ੍ਹਾਂ ਨੇ ਕੰਪਲੇਂਟ ਕੀਤੀ ਹੈ ਜੇ ਖਾਣੇ 'ਚ ਕੋਈ ਖ਼ਰਾਬੀ ਹੁੰ ਹਾਂਜੀ ਹਾਂਜੀ ਹਾਂਜੀ ਤੁਸੀਂ ਕਦੇ ਵੀ ਮੈਨੂੰ ਫ਼ੋਨ ਕਰਕੇ ਮੇਰੀ ਦੁਕਾਨ 'ਤੇ ਕਿਸੇ ਵੀ ਟਾਈਮ ਤੁਸੀਂ ਕੰਟੀਨ ਆਓ ਆਪਾਂ ਬੈਠ ਕੇ ਗੱਲ ਕਰਾਂਗੇ ਅਤੇ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੰਪਲੇਂਟ ਹੋਈ ਉਸ ਨੂੰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਓਕੇ ਜੀ ਥੈਂਕ ਯੂ